ਪੰਜਾਬ ਵਿੱਚ ਹਰ ਵਰਗ ਹਰ ਬੰਦੇ ਦੀ ਹਰ ਕਹਿ ਲਓ ਔਰਤ ਹਰ ਬੱਚੇ ਦੀ ਮਦਦ ਲਈ ਨਵੀਂ ਨਵੀਆਂ ਕਾਢਾਂ ਕੱਢੀਆਂ ਗਈਆਂ ਹਨ ਜਿਵੇਂ ਕਿ ਅਗਰ ਕਿਸੇ ਮਰਦ ਨੂੰ ਕੋਈ ਵੀ ਦਿੱਕਤ ਆ ਰਹੀ ਹੈ ਉਹਨੂੰ ਕੋਈ ਤੰਗ ਕਰ ਰਿਹਾ ਹੈ ਜਾਂ ਉਹਦੇ ਉਹਦੇ ਨਾਲ ਕੋਈ ਘਟਨਾ ਵਾਪਰ ਗਈ ਹੈ ਅਤੇ ਉਹ ਭਾਰਤੀ ਨ ਨਿਆਏ ਸਮਿਤੀ ਵਿੱਚ ਜਾ ਸਕਦਾ ਹੈ ਪੁਲਿਸ ਕਰਮੀ ਨਾਲ ਗੱਲ ਕਰ ਸਕਦਾ ਹੈ ਪੁਲਿਸ 'ਚ ਸ਼ਿ ਸ਼ਿਕਾਇਤ ਦਰਜ ਕਰਵਾ ਸਕਦਾ ਹੈ ਅਤੇ ਜਿਸ ਨਾਲ ਕਿ ਉਹਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਅਤੇ ਔਰਤਾਂ ਪ੍ਰਤੀ ਅਗਰ ਔਰਤਾਂ ਨੂੰ ਕੋਈ ਵੀ ਦਿੱਕਤ ਆ ਰਹੀ ਹੈ ਉਹਨਾਂ ਨੂੰ ਕੋਈ ਤੰਗ ਕਰ ਰਿਹਾ ਹੈ ਉਹਨਾਂ ਨਾਲ ਵੀ ਕੋਈ ਘਟਨਾ ਵਾਪਰ ਚੁੱਕੀ ਹੈ ਉਹਨਾਂ ਦਾ ਘਰ ਵਾਲਾ ਉਹਨਾਂ ਦੇ ਉੱਪਰ ਹੱਥ ਚੱਕਦਾ ਹੈ ਘਰ ਦੀ ਕੋਈ ਵੀ ਸਮੱਸਿਆ ਹੈ ਜਿਹੜੀ ਕਿ ਬਹੁਤ ਹੀ ਵੱਡੀ ਸਮੱਸਿਆ ਹੈ ਅਤੇ ਜਿਹਦੇ ਨਾਲ ਉਹਨਾਂ ਨੂੰ ਮਾਨਸਿਕ ਅਤੇ ਮਾਨਸਿਕ ਤਣਾਅ ਹੋ ਰਿਹਾ ਹੈ ਅਤੇ ਫਿਜੀਕਲ ਤਣਾਅ ਹੋ ਰਿਹਾ ਹੈ ਤਾਂ ਫਿਰ ਉਹ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਨੇ ਇੱਕ ਸਿਫਰ ਨੌ ਇੱਕ ਇਹ ਵੂਮਨ ਹੈਲਪਲਾਈਨ ਹੈਗੀ ਹੈ ਇਹਦੇ 'ਤੇ ਸ਼ਿਕਾਇਤ ਦਰਜ ਕਰਵਾ ਕੇ ਉਹਨਾਂ ਦੀ ਸ਼ਿਕਾਇਤ ਦਾ ਹੱਲ ਤੁਰੰਤ ਹੀ ਕੀਤਾ ਜਾਵੇਗਾ ਜੋ ਕਿ ਬਹੁਤ ਵਧੀਆ ਚੀਜ਼ ਹੈ ਅਤੇ ਅਗਰ ਬੱਚੇ ਛੋਟੇ ਛੋਟੇ ਬੱਚਿਆਂ ਨੂੰ ਕੋਈ ਤੰਗ ਕਰਦਾ ਉਹਨਾਂ ਉੱਪਰ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਉਹਦੇ ਲਈ ਵੀ ਸਰਕਾਰਾਂ ਨੇ ਹੈਲਪਲਾਈਨ ਲਾਂਚ ਕੀਤੀ ਹੈ ਜੋ ਇੱਕ ਇੱਕ ਸਿਫਰ ਨੌ ਅੱਠ ਚਾਇਲਡ ਹੈਲਪਲਾਈਨ ਹੈ ਇਹਦੇ 'ਚ ਉਹ ਕੋਈ ਵੀ ਅਗਰ ਬੱਚੇ ਨੂੰ ਕੋਈ ਵੀ ਤਣਾਅ ਦਿੱਕਤ ਹੋ ਰਹੀ ਹੈ ਤਾਂ ਉਹ ਇਸ ਤੋਂ ਇੱਥੇ ਸ਼ਿਕਾਇਤ ਦਰਜ ਕਰਵਾ ਕਰ ਦਰਜ ਕਰਵਾ ਕੇ ਅਤੇ ਉਹਨਾਂ ਦੀ ਸ਼ਿਕਾਇਤਾਂ ਦਾ ਹੱਲ ਤੁਰੰਤ ਕੀਤਾ ਜਾਵੇਗਾ ਅਤੇ ਇਸ ਤਰੀਕੇ ਨਾਲ ਜੋ ਕਿ ਹੈ ਆਪਣੀ ਸਰਕਾਰਾਂ ਸਾਰੀਆਂ ਸਮੂਹਾਂ ਨੂੰ ਬਚਾ ਰਹੀ ਹੈ